ਐਮੇਜ਼ਨ ਦੀ ਵੈੱਬਸਾਈਟ ਤੋਂ ਇਹ ਕਿਤਾਬ ਮੰਗਵਾਈ ਸੀਗੀ ਅਤੇ ਉਹ ਕਿਤਾਬ ਜਦ ਮਿਲ ਮੈਨੂੰ ਮਿਲੀ ਤਾਂ ਮੈਨੂੰ ਉਹ ਕਿਤਾਬ ਬੜੀ ਚੰਗੀ ਲੱਗੀ ਕਿਉਂਕਿ ਉਸ ਦੇ ਵਿੱਚ ਸਾਰੀ ਚੀਜ਼ਾਂ ਉਵੇਂ ਹੀ ਸਨ ਜਿਵੇਂ ਕਿ ਮੈਨੂੰ ਚਾਹੀਦੀਆਂ ਸਨ ਉਸ ਦੇ ਸਾਰੇ ਪਾਠ ਵੀ ਉਸ ਵਿੱਚ ਮੌਜੂਦ ਸਨ ਇਸ ਤੋਂ ਇਲਾਵਾ ਜੇਕਰ ਮੈਂ ਗੱਲ ਕਰਾਂ ਉਸ ਦੇ ਪੇਜਾਂ ਦੀ ਤਾਂ ਉਸ ਦੇ ਪੇਜਾਂ ਦੀ ਕੁਆਲਿਟੀ ਵੀ ਬਹੁਤ ਅੱਛੀ ਸੀ ਅਤੇ ਉਸ ਦੇ ਅੰਦਰ ਦੀ ਲਿਖਾਵਟ ਸੀ ਉਹ ਵੀ ਬਹੁਤ ਅੱਛੇ ਤਰੀਕੇ ਨਾਲ ਸਮਝ ਆਉਂਦੀ ਸੀ